ਹਾਂਜੀ ਸਰ ਤੁਸੀਂ ਆ ਗਏ ਹੋ ਬੜਾ ਸਮਾਂ ਲੱਗ ਗਿਆ ਪਹਿਲਾਂ ਹੀ ਲੇਟ ਹੋ ਗਏ ਆਪਾਂ ਤਾਂ ਚਲੋ ਆਪਾਂ ਚੱਲਦੇ ਹਾਂ ਅਤੇੇ ਤੁਸੀਂ ਮੈਨੂੰ ਦੱਸੋ ਕਿ ਆਪਾਂ ਕਿੰਨੇ ਕੁ ਸਮੇਂ ਤੱਕ ਜਿਹੜਾ ਹੈ ਰਣਜੀਤ ਐਵਨਿਊ ਪਹੁੰਚ ਜਾਵਾਂਗੇ ਉੱਥੇ ਪਹੁੰਚਣ ਨੂੰ ਕਿੰਨਾ ਸਮਾਂ ਲੱਗੇਗਾ ਬਾਹਰ ਵੇਖੋ ਕਿੰਨੀ ਟਰੈਫਿਕ ਹੋ ਗਈ ਹੈ ਅਤੇ ਮੇਰਾ ਸਮੇਂ 'ਤੇ ਪਹੁੰਚਣਾ ਬਹੁਤ ਜ਼ਰੂਰੀ ਹੈ ਤੁਸੀਂ ਦੱਸੋ ਕਿ ਆਪਾਂ ਕਿੰਨੇ ਚਿਰ ਵਿੱਚ ਪਹੁੰਚ ਸਕਦੇ ਹਾਂ ਜੇ ਮੈਂ ਲੇਟ ਹੋ ਗਈ ਤਾਂ ਬੜੀ ਮੁਸ਼ਕਲ ਹੋ ਜਾਵੇਗੀ ਕਿਉਂਕਿ ਮੈਂ ਵਿਆਹ 'ਤੇ ਜਾਣਾ ਹੈ ਅਤੇ ਉਹਨਾਂ ਵਿਆਹ ਵਾਲਿਆਂ ਦਾ ਕੁਝ ਸਮਾਨ ਮੇਰੇ ਕੋਲ ਹੈ ਅਤੇ ਉਹ ਦੇਣਾ ਬਹੁਤ ਹੀ ਜ਼ਰੂਰੀ ਹੈ ਵਿਆਹ ਵਾਲੇ ਘਰ ਤੋਂ ਮੈਨੂੰ ਕਈ ਕੋਲਸ ਵੀ ਆ ਗਈਆਂ ਨੇ ਇਸ ਲਈ ਜਲਦੀ ਤੋਂ ਜਲਦੀ ਮੈਨੂੰ ਉੱਥੇ ਪਹੁੰਚਾ ਦਿਓ ਉਹ ਇਸ ਗੱਲੋਂ ਬਹੁਤ ਪਰੇਸ਼ਾਨ ਹਨ ਕਿ ਸਮਾਨ ਹਾਲੇ ਤੱਕ ਨਹੀਂ ਪਹੁੰਚਿਆ ਹੈ ਅਤੇ ਮੈਂ ਇੱਥੇ ਟਰੈਫਿਕ ਵਿੱਚ ਫਸੀ ਹੋਈ ਹਾਂ ਸਰ ਦੇਖੋ ਜੇ ਆਪਾਂ ਨੂੰ ਕੋਈ ਸ਼ੋਟਕੱਟ ਰਸਤਾ ਮਿਲੇ ਜਿੱਥੋਂ ਆਪਾਂ ਥੋੜ੍ਹੀ ਤੇਜ਼ੀ ਦੇ ਨਾਲ ਨਿਕਲ ਸਕੀਏ ਤਾਂ ਕਿ ਜੋ ਇਹ ਟਰੈਫਿਕ ਹੈ ਇਹ ਆਪਾਂ ਲੰਘ ਸਕੀਏ ਆਪਣਾ ਰਸਤਾ ਬਦਲ ਕੇ ਦੇਖ ਲਈਏ ਕੋਈ ਸ਼ੋਟਕੱਟ ਹੈ ਜਿੱਥੋਂ ਆਪਾਂ ਜਲਦੀ ਜਲਦੀ ਪਹੁੰਚ ਸਕੀਏ ਤੁਸੀਂ ਕਿਸੇ ਨੂੰ ਵੀ ਕਾਲ ਕਰਕੇ ਆਪਣੇ ਸੰਗੀ ਸਾਥੀ ਨੂੰ ਪੁੱਛੋ ਕਿ ਕੋਈ ਹੋਰ ਰਸਤਾ ਹੈ ਅਤੇ ਆਪਣੇ ਆਪਾਂ ਨਿਸ਼ਚਿਤ ਸਥਾਨ 'ਤੇ ਪਹੁੰਚ ਸਕੀਏ ਪਲੀਜ਼ ਜਲਦੀ ਕਰੋ ਤੁਹਾਡੀ ਬਹੁਤ ਬਹੁਤ ਮਿਹਰਬਾਨੀ ਹੋਵੇਗੀ